ਹੈਲੋ ਤੁਸੀਂ ਗਿਆਨ ਦੇ ਢਾਬੇ ਤੋਂ ਬੋਲ ਰਹੇ ਹੋ ਮੈਂ ਤੁਹਾਡੀ ਰੈਗੂਲਰ ਕਸਟਮਰ ਮਨਜੋਤ ਕੌਰ ਬੋਲ ਰਹੀ ਹਾਂ ਕੱਲ੍ਹ ਮੇਰੇ ਘਰ ਇੱਕ ਫੰਕਸ਼ਨ ਆ ਜਿਹਦੇ ਕਰਕੇ ਮੈਂ ਕੁਝ ਓਰਡਰ ਕਰਨਾ ਚਾਹੁੰਦੀ ਹਾਂ ਕੁਝ ਸਪੈਸ਼ਲ ਆਈਟਮਸ ਮੈਂ ਸੁਣਿਆ ਕਿ ਗਿਆਨ ਦੇ ਢਾਬੇ ਦੀਆਂ ਕੋਈ ਸਪੈਸ਼ਲ ਆਈਟਮਸ ਨੇ ਸੋ ਮੈਂ ਉਹ ਓਰਡਰ ਕਰਨਾ ਚਾਹੁੰਦੀ ਹਾਂ ਜਿਵੇਂ ਕਿ ਬਟਰ ਨਾਨ ਪਨੀਰ ਕੁਲਚਾ ਇੱਕ ਫੁੱਲ ਥਾਲੀ ਰਾਜਮਾ ਚਾਵਲ ਅਤੇ ਮਿੱਠੇ ਵਿੱਚ ਗੁਲਾਬ ਜਾਮੁਣ ਰਸਗੁੱਲੇ ਅਤੇ ਤੁਸੀਂ ਇੱਦਾਂ ਕਰਿਓ ਇੱਕ ਪੇਸਟਰੀਜ਼ ਵੀ ਘੱਲ ਦਿਓ ਗਿਆਰਾਂ ਬਾਰਾਂ ਔਰ ਇਹ ਮੈਨੂੰ ਕੱਲ੍ਹ ਚਾਹੀਦਾ ਆ ਯਾਨੀ ਕਿ ਬਾਰਾਂ ਜਨਵਰੀ ਦਿਨ ਸ਼ੁਕਰਵਾਰ ਦਾ ਕੋਸ਼ਿਸ਼ ਕਰਿਓ ਕਿ ਮੈਨੂੰ ਦੋ ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਡਿਲੀਵਰ ਕਰ ਦਿਉ ਔਰ ਮੈਂ ਕੈਸ਼ ਔਨ ਡਿਲੀਵਰੀ ਕਰ ਦੂਗੀ ਓਨ ਸਪੋਰਟ ਔਰ ਥੈਂਕ ਯੂ ਸੋ ਮਚ